ਹੈਲੋ ਕਿੱਦਾਂ ਬੱਚੇ ਕੀ ਹਾਲ ਚਾਲ ਆ ਬੜੇ ਦਿਨਾਂ ਬਾਅਦ ਦਿੱਖੀ ਇਧਰ ਮੈਂ ਵਧੀਆ ਪੁੱਤ ਕਿੱਧਰ ਨੂੰ ਜਾਂਦੀ ਪਈ ਆ ਅਤੇ ਹੋਰ ਸਕੂਲ ਕਿੱਦਾਂ ਫਿਰ ਹਾਂ ਪੁੱਤ ਸਾਰਿਆਂ ਨਾਲ ਮੈਂ ਉਦੋਂ ਜ਼ਿਆਦਾ ਵੱਡੀ ਨਹੀਂ ਸੀ ਪੰਜ ਛੇ ਸਾਲਾਂ ਦੀ ਹੋਵੇਗੀ ਬਟ ਮੇਰੇ ਬਾਪੂ ਅਤੇ ਬੇਬੇ ਮੈਨੂੰ ਬਹੁਤ ਗੱਲਾਂ ਦੱਸਦੇ ਹੁੰਦੇ ਸੀ ਉਸ ਸਮੇਂ ਦੀਆਂ ਕਿ ਸਾਡੇ ਨਾਲ ਕੀ ਹੋਇਆ ਸੀ ਅਸੀਂ ਨਾ ਲਾਹੌਰ ਰਹਿੰਦੇ ਹੁੰਦੇ ਸੀ ਸਾਡੀ ਵਾਹ ਵਾਹ ਤੋਂ ਵੱਡੀ ਹੁੰਦੀ ਸੀ ਸਾਡਾ ਸਾਰਾ ਪਰਿਵਾਰ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ ਅਤੇ ਉਸ ਵੇਲੇ ਲਾਹੌਰ ਦੇ ਵਕਤ ਸਾਡੇ ਬਹੁਤ ਮੱਝਾਂ ਅਤੇ ਗਾਵਾਂ ਹੁੰਦੀਆਂ ਸੀ ਉਹਨੇ ਡੇਰੀ ਦਾ ਕੰਮ ਹੁੰਦਾ ਸੀ ਸਾਡਾ ਸਾਰੇ ਪੂਰੇ ਸ਼ਹਿਰ ਦੇ ਵਿੱਚ ਬੜੇ ਮਸ਼ਹੂਰ ਹੁੰਦੇ ਸੀ ਅਸੀਂ ਅਤੇ ਇੱਦਾਂ ਦੀ ਗੱਲ ਆ ਇੱਕ ਰਾਤ ਦੀ ਗੱਲ ਆ ਰੌਲਾ ਬੜਾ ਪੈ ਗਿਆ ਉਥੇ ਸਾਡੇ ਗਵਾਂਢ 'ਚ ਲੋਕੀ ਉਹ ਮੁਸਲਮਾਨ ਹੀ ਸੀਗੇ ਔਰ ਸਾਡੇ ਰਿਸ਼ਤੇਦਾਰ ਹੀ ਲੱਗਦੇ ਸੀ ਮਤਲਬ ਸਾਡਾ ਬੋਲਚਾਲ ਸੀ ਵਾਹ ਵਾਹ ਉਹਨਾਂ ਨਾਲ ਤਾਂ ਉਹ ਸਾਡੇ ਕੋਲ ਆਏ ਸਾਨੂੰ ਕਹਿੰਦੇ ਕਿ ਦੇਖੋ ਮਾਹੌਲ ਖ਼ਰਾਬ ਹੋ ਗਿਆ ਬਹੁਤ ਜ਼ਿਆਦਾ ਤੁਸੀਂ ਤੁਰ ਜੋ ਇੰਡੀਆ ਵੱਲ ਮਤਲਬ ਹੁਣ ਭਾਰਤ ਵੱਲ ਤੁਰ ਜਾਓ ਪੰਜਾਬ ਚਲ ਜਾਓ ਅਤੇ ਅਸੀਂ ਕਿਸੇ ਤਰਾਂ ਉਸੇ ਰਾਤ ਨੂੰ ਸਾਰਾ ਸਮਾਨ ਸਾਰਿਆਂ ਨੇ ਜਿਹੜਾ ਜ਼ਰੂਰੀ ਸੀਗਾ ਬੰਨ੍ਹ ਬੁੰਨ ਕੇ ਸਾਰੀਆਂ ਮੱਝਾਂ ਲੈ ਕੇ ਅਸੀਂ ਸਾਰੇ ਤੁਰ ਪਏ ਅੰਮ੍ਰਿਤਸਰ ਵੱਲ ਨੂੰ ਅਤੇ ਜਦੋਂ ਅਸੀਂ ਰਸਤੇ 'ਚ ਜਾਂਦੇ ਪਏ ਸੀਗੇ ਪਹਿਲਾਂ ਤਾਂ ਸਾਡਾ ਸਫ਼ਰ ਸਹੀ ਰਿਹਾ ਬਟ ਜਦੋਂ ਜਿੱਦਾਂ ਹੀ ਅਸੀਂ ਅੰਮ੍ਰਿਤਸਰ ਵੱਲ ਪਹੁੰਚਣ ਹੀ ਲੱਗੇ ਸੀ ਉਸ ਤੋਂ ਪਹਿਲਾਂ ਹੀ ਸਾਨੂੰ ਉੱਥੇ ਜਿਹੜੇ ਲੋਕੀ ਸੀ ਜੋ ਫੜ ਫੜ ਕੇ ਮਾਰਦੇ ਪਏ ਸੀ ਉਹਨਾਂ ਨੇ ਸਾਨੂੰ ਫੜ ਲਿਆ ਅਤੇ ਅਸੀਂ ਅਸੀਂ ਤਾਂ ਬੜਾ ਸਾਰੇ ਮੇਰੀ ਬੇਬੇ ਦੱਸ ਰਹੀ ਸੀ ਵੀ ਬੜਾ ਡਰ ਗਏ ਸੀ ਉਹਨਾਂ ਦੀ ਤਰਲੇ ਕੀਤੇ ਹੱਥ ਜੋੜੇ ਕਿ ਸਾਨੂੰ ਜਾਣ ਦਿਓ ਨਿਆਣੇ ਛੋਟੇ ਸੀਗੇ ਅਤੇ ਫਿਰ ਉਹਨਾਂ ਨੇ ਨਾ ਸਾਡੀਆਂ ਮੱਝਾਂ ਦੇਖੀਆਂ ਵਾਹਵਾ ਕਿਆ ਮੱਝਾਂ ਸੀਗੀਆਂ ਸਾਡੀਆਂ ਵੀਹ ਪੱਚੀ ਕੁ ਹੋਣਗੀਆਂ ਅਤੇ ਬਹੁਤ ਵਧੀਆ ਨਸਲ ਦੀਆਂ ਸੀਗੀਆਂ ਉਸ ਵਕਤ ਦੀਆਂ ਉਹਨਾਂ ਨੇ ਮੇਰੇ ਬਾਪੂ ਨੂੰ ਸਿੱਧਾ ਕਹਿ ਤਾਂ ਕਿ ਸਾਨੂੰ ਆਹ ਫੜਾ ਦਿਓ ਆਪਣੀਆਂ ਸਾਰੀਆਂ ਮੱਝਾਂ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਜਾਣ ਦੇਵਾਂਗੇ ਫਿਰ ਬਾਪੂ ਨੇ ਜ਼ਿਆਦਾ ਸੋਚਿਆ ਨਹੀਂ ਹੋਰ ਪੁੱਤ ਦੇਣੀਆਂ ਹੀ ਪੈਣੀਆਂ ਸੀ ਉਹਨਾਂ ਨੇ ਫਿਰ ਸਾਨੂੰ ਫੜ ਕੇ ਉੱਥੇ ਰੱਖ ਲੈਣਾ ਸੀਗਾ ਪਹੁੰਚਣ ਹੀ ਨਹੀਂ ਦੇਣਾ ਸੀਗਾ ਅਤੇ ਫਿਰ ਬਾਪੂ ਨੇ ਸਲਾਹ ਕੀਤੀ ਆਪਣੇ ਮਤਲਬ ਮੇਰੇ ਦਾਦਾ ਜੀ ਨਾਲ ਉਸ ਵਕਤ ਅਤੇ ਫਿਰ ਉਹਨਾਂ ਨੇ ਸਾਰੀਆਂ ਦੇ ਦਿੱਤੀਆਂ ਅਤੇ ਫਿਰ ਕਿਸੇ ਤਰ੍ਹਾਂ ਸੋਨਾ ਵੀ ਲੈ ਲਿਆ ਸਾਡਾ ਸਾਡਾ ਵਾਹਵਾ ਸੋਨਾ ਸੀਗਾ ਉਸ ਵਕਤ ਉਹ ਵੀ ਲੈ ਲਿਆ ਜਿੰਨੇ ਵੀ ਪੈਸੇ ਪੂਸੇ ਸੋਨੇ ਸੀਗੇ ਔਰ ਹਾਂ ਮੇਰੇ ਨਾ ਦਾਦੂ ਕੋਲ ਇੱਕ ਬਹੁਤ ਵੱਡੀ ਉਹ ਪਿਸਟਲ ਵੀ ਸੀ ਉਸ ਵਕਤ ਜਿਹੜੀ ਉਹਨਾਂ ਨੇ ਰੱਖੀ ਸੀਗੀ ਉਹਨਾਂ ਨੇ ਉਹ ਵੀ ਰੱਖ ਲਈ ਅਤੇ ਇਹ ਸਾਰਾ ਸਮਾਨ ਰੱਖ ਕੇ ਫਿਰ ਉਹਨਾਂ ਨੇ ਕਿਹਾ ਕਿ ਠੀਕ ਆ ਚੱਲ ਜਾਓ ਤੁਸੀਂ ਅਤੇ ਫਿਰ ਜਾ ਕੇ ਅਸੀਂ ਕਿਤੇ ਅੰਮ੍ਰਿਤਸਰ ਰੁਕੇ ਔਰ ਉਸ ਤੋਂ ਬਾਅਦ ਵੀ ਸਾਡਾ ਬਹੁਤਾ ਔਖਾ ਹੋਇਆ ਅੰਮ੍ਰਿਤਸਰ ਸਾਨੂੰ ਡੇਢ ਕੁ ਮਹੀਨਾ ਤਾਂ ਸਾਨੂੰ ਉਹਨਾਂ ਨੇ ਉਹ ਨਹੀਂ ਕਿਹੜਾ ਤੁਸੀਂ ਕੈਂਪ ਬੋਲਦੇ ਆ ਰੈਫੀਉਜੀ ਕੈਂਪ ਬੋਲਦੇ ਆ ਨਾ ਉੱਥੇ ਸਾਨੂੰ ਡੇਢ ਕੁ ਮਹੀਨਾ ਉੱਥੇ ਰੱਖਿਆ ਫਿਰ ਸਾਨੂੰ ਉੱਥੇ ਥੋੜ੍ਹੀ ਦੇਰ ਵਾਸਤੇ ਕਿਉਂਕਿ ਪਾਣਾ ਪਾਣੀ ਖਾਣਾ ਇਹ ਸਭ ਸੀਗਾ ਅਤੇ ਸਾਨੂੰ ਗੁਰਦੁਆਰੇ ਵੀ ਰਹਿਣਾ ਪਿਆ ਬਹੁਤ ਦੇਰ ਵਾਸਤੇ

ਹਾਂ ਉਸ ਵਕਤ ਦਾ ਮਾਹੌਲ ਹੀ ਬੜਾ ਖ਼ਰਾਬ ਸੀਗਾ ਉੱਦਾਂ ਹੀ ਘਰਾਂ ਨੂੰ ਅੱਗ ਲਾ ਦਿੰਦੇ ਹੁੰਦੇ ਸੀਗੇ ਬੰਦ ਕ ਅੱਗ ਲਾਈ ਜਾਂਦੇ ਸੀਗੇ ਉੱਦਾਂ ਹੀ ਲੋਕਾਂ ਨੂੰ ਫੜ ਕੇ ਮਾਰ ਦਿੰਦੇ ਸੀਗੇ ਜਿਹੜੇ ਸਰਦਾਰ ਹੁੰਦੇ ਸੀ ਉਹਨਾਂ ਨੂੰ ਤਾਂ ਦੇਖਦੇ ਹੁੰਦੇ ਸੀ ਅਤੇ ਨਾਲ ਹੀ ਵੱਡੇ ਵੱਡੇ ਤਲਵਾਰਾਂ ਹੁੰਦੀਆਂ ਸੀ ਹਰ ਕਿਸੇ ਕੋਲ ਔਖਾ ਸੀਗਾ ਸਾਨੂੰ ਦੱਸਦੇ ਸੀ ਕਿ ਬਾਹਰ ਜਾਣਾ ਔਖਾ ਹੋਇਆ ਪਿਆ ਸੀ ਘਰੋਂ ਬਾਹਰ ਨਿਕਲਣਾ ਮਨਾਹੀ ਸੀਗੀ ਵੀ ਰਹਿਣ ਦਿਓ ਤੁਸੀਂ ਘਰੇ ਹੀ ਰਹੋ ਉਹ ਸ਼ਾਮ ਦਾ ਵੇਲਾ ਹੋ ਗਿਆ ਵਾ ਮੈਂ ਵੀ ਹੁਣ ਦੁੱਧ ਲੈਣ ਚੱਲੀ ਹਾਂ ਮਿਲਦੀ ਰਿਹਾ ਕਰ ਤੂੰ ਘੱਟ ਤੂੰ ਘੱਟ ਹੀ ਨਿਕਲਦੀ ਆ ਘਰੋਂ ਹਾਂ ਚੰਗਾ ਪੁੱਤ ਚੰਗਾ ਹਾਂ ਸਤਿ ਸ਼੍ਰੀ ਅਕਾਲ